ਹੈਲੋ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਨਿਊ ਫੈਸ਼ਨ ਡਿਜ਼ਾਇਨਿੰਗ ਓਕੇ ਓਕੇ ਹਾਂਜੀ ਹਾਂਜੀ ਭਾਅ ਜੀ ਥੋਨੂੰ ਮੈਂ ਇੱਕ ਵਾਰੀ ਮੇਨ ਮੇਨ ਮੋਟਾ ਮੋਟਾ ਜਿਹਾ ਬਣਾ ਕੇ ਦੱਸ ਦਿੰਨਾ ਤੇ ਇਹਦੇ ਤੇ ਭਾਅ ਜੀ ਆਪਾਂ ਆਹਾ ਸਿਸਟਮ ਆ ਕਿ ਜਿਵੇਂ ਤੁਸੀਂ ਬਾਹਰ ਹੁਣ ਜਾ ਰਹੇ ਹੋ ਠੀਕ ਆ ਐਸ ਟਾਈਮ ਹੈਗਾ ਸਰਦੀ ਤੇ ਸਨੋਅ ਪੈ ਰਹੀ ਆ ਪੂਰੀ ਹਾਂਜੀ ਸਨੋਅ ਪੈ ਰਹੀ ਹੈ ਸਨੋਅ 'ਚ ਨਾ ਫਿਰ ਤੁਸੀਂ ਭਾਅ ਜੀ ਤੁਹਾਨੂੰ ਚਾਹੀਦੀ ਹੈ ਘੱਟੋ ਘੱਟ ਮਾਈਨਸ ਜੈਕਟ ਚਾਹੀਦੀਆਂ ਨੇ ਜਿਹੜੀ ਮਾਈਨਸ ਚਲਦੀਆਂ ਹੋਣ ਤੇ ਸਾਡੇ ਕੋਲ ਭਾਅ ਜੀ ਹੁਣੇ ਨਾ ਚਾਰ ਜੈਕਟ ਆਈਆਂ ਨੇ ਮਤਲਬ ਕੰਫਰਟੇਬਲ ਤੇ ਬਹੁਤ ਵਧੀਆ ਨੇ ਕਲਰ ਵੀ ਉਹਦੇ ਚ ਅਲੱਗ ਅਲੱਗ ਨੇ ਸਾਰੇ ਤੇ ਜੇ ਤੁਸੀਂ ਕਹੋਗੇ ਸੇਮ ਕਲਰ ਵੀ ਚਾਹੀਦਾ ਤੁਹਾਡਾ ਯਾਰ ਦੋਸਤ ਨੂੰ ਤੇ ਤੁਹਾਨੂੰ ਤੇ ਉਹ ਵੀ ਅਸੀਂ ਮੰਗਾਦੇ ਆ ਉਹ ਵੀ ਅਸੀਂ ਪ੍ਰੋਵਾਈਡ ਕਰ ਦਾਂਗੇ ਤੇ ਬੜਾ ਵਧੀਆ ਭਾਜੀ ਉਹ ਸਿਸਟਮ ਆ ਤੇ ਤੁਸੀਂ ਬੜਾ ਵਧੀਆ ਹੋ ਤੁਸੀਂ ਆ ਕੇ ਇੱਕ ਵਾਰੀ ਵਿਜਿਟ ਕਰ ਸਕਦੇ ਹੋ ਦੁਕਾਨ ਤੇ ਨਹੀਂ ਨਹੀਂ ਨਹੀਂ ਭਾਜੀ ਨਹੀਂ ਨਹੀਂ ਭਾਅ ਜੀ ਤੁਹਾਨੂੰ ਵਾਰੰਟੀ ਪਲਸ ਬਿਲ ਦਵਾਂਗੇ ਕੱਟ ਕੇ ਪਿਓਰ ਠੀਕ ਹੈ ਨਾ ਜੀ ਜੇ ਤੁਸੀਂ ਬਾਈ ਚਾਂਸ ਜੇ ਉਹ ਖਰਾਬ ਹੁੰਦੀ ਆ ਤੁਸੀਂ ਸਾਡੇ ਕੋਲ ਲੈ ਕੇ ਆਣੀ ਆ ਅਸੀਂ ਤੁਹਾਨੂੰ ਚੇਂਜ ਕਰਕੇ ਦਵਾਂਗੇ ਨਾਲ ਪਲਸ ਇੱਕ ਹੋਰ ਦੇ ਦਾਂਗੇ ਫਰੀ ਚ ਜੇ ਉਹ ਖਰਾਬ ਹੋਏਗੀ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਸਾਡੇ ਕੋਲ ਸਮਰ ਸਮਰ ਅਰਾ ਸਮਰ ਅਰਾਈਵਲ ਹੁਣੇ ਆਏ ਨੇ ਸਮਰ ਵੀ ਕੱਪੜੇ ਹੁਣੇ ਅਸੀਂ ਖੋਲੇ ਈ ਨੇ ਜਸਟ ਨਾਓ ਤੇ ਬੜੇ ਵਧੀਆ ਵਧੀਆ ਪੀਸ ਨਿਕਲੇ ਨੇ ਨਿਊ ਨਿਊ ਡਿਜ਼ਾਇਨ ਨੇ ਤੁਸੀਂ ਇੱਕ ਵਾਰੀ ਥੋਨੂੰ ਮੈਂ ਫੋਟੋ ਭੇਜ ਦੂਗਾ ਤੇ ਤੁਸੀਂ ਚੈੱਕ ਕਰਕੇ ਦੱਸ ਦਿਓ ਕਿਹੜੇ ਸਿਲੈਕਟ ਕਰਨੇ ਆ ਆਪਾਂ ਉਹ ਸਿਲੈਕਟ ਉਸ ਹਿਸਾਬ ਨਾਲ ਜੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਤਾਂ ਠੀਕ ਆ ਨਹੀਂ ਅਸੀਂ ਥੋਡੇ ਕੋਲ ਕੋਰੀਅਰ ਕਰਾਦਾਂਗੇ ਤੁਸੀਂ ਆਪਣਾ ਇੱਕ ਵਾਰੀ ਸਾਈਜ਼ ਦੱਸ ਦੋ ਕਿਹੜਾ ਸਾਈਜ਼ ਆ ਥੋਡਾ ਡਬਲ ਐਕਸਲ ਟ੍ਰਿਪਲ ਐਕਸਲ ਸਾਡੇ ਕੋਲ ਟ੍ਰਿਪਲ ਐਕਸਲ ਤੱਕ ਪਏ ਨੇ ਕੱਪੜੇ ਆ ਬ੍ਰੈਂਡ ਭਾਅ ਜੀ ਅਸੀਂ ਸਿਰਫ ਨਹੀਂ ਨਹੀਂ ਬ੍ਰੈਂਡ ਅਸੀਂ ਸਿਰਫ ਨਹੀਂ ਰੱਖਦੇ ਹੈਗੇ ਸਾਡੇ ਫਸਟ ਸ਼ੋਪ ਈ ਆ ਬਟ ਅਸੀਂ ਦੋ ਕ ਬ੍ਰੈਂਡ ਰੱਖੇ ਹੋਏ ਨੇ ਹਾਂਜੀ ਦੋ ਕ ਬ੍ਰੈਂਡ ਨਾਲ ਅਸੀਂ ਕੋਲੈਬ ਕੀਤਾ ਹੋਇਆ ਐ ਬਟ ਓਹ ਬੜਾ ਔਖਾ ਉਹ ਅਸੀਂ ਭਾਅ ਜੀ ਇੱਕ ਛੋਟੇ ਮੋਟੇ ਜੇ ਹੀ ਨੇ ਕੋਈ ਬਹੁਤੇ ਇੰਨੇ ਸੁਣਨਦਾਇਕ ਸੁਣੇ ਨੀ ਹੋਣੇ ਤੁਸੀਂ ਇੱਕ ਤਾਂ ਜਿਵੇਂ ਪਤਾ ਨਹੀਂ ਕਿਹੜਾ ਤਾਂ ਮੈਨੂੰ ਯਾਦ ਨਹੀਂ ਆ ਰਿਹਾ ਹੁਣ ਤੇ ਉਹ ਸੀਗੇ ਦੋ ਕ ਬਰੈਂਡ ਨੇ ਤੇ ਉਹ ਅਸੀਂ ਰੱਖੇ ਹੋਏ ਆ ਤੁਸੀਂ ਇੱਕ ਵਾਰੀ ਆ ਕੇ ਦੇਖ ਜਾਇਓ ਜੀ ਅਸੀਂ ਕੱਪੜੇ ਉਹ ਕੱਪੜਾ ਨੀ ਹੈ ਉਹਦੇ ਨਾ ਅਸੀਂ ਜਿਆਦਾਤਰ ਰੁਮਾਲ ਹੋ ਗਿਆ ਜਰਾਬਾਂ ਹੋਗੀਆਂ ਬਨੈਨਾਂ ਹੋਗੀਆ ਉਹ ਬ੍ਰੈਂਡ ਆ ਕੱਪੜਿਆਂ ਦਾ ਸੀ ਫਸਟ ਟੋਪ ਹੀ ਰੱਖਦੇ ਆ ਸ਼ੂਜ ਭਾਅ ਜੀ ਸਾਡੇ ਬ੍ਰਦਰ ਦੀ ਦੁਕਾਨ ਨਾਲੇ ਤੇ ਉਹ ਉਹਨਾਂ ਨੇ ਰੱਖੇ ਹੋਏ ਨੇ ਤੇ ਉਹਨਾਂ ਕੋਲ ਵੀ ਤੁਸੀਂ ਜੇ ਬਾਹਰ ਵਾਸਤੇ ਲੈ ਕੇ ਜਾਣੇ ਆ ਸਮਰ ਸ਼ੂਜ ਵਿੰਟਰ ਸ਼ੂਜ ਤਾਂ ਤੁਸੀਂ ਲਿਜਾ ਸਕਦੇ ਹੋ

ਓਕੇ ਉਹ ਭਾਅ ਜੀ ਸਾਡੇ ਕੋਲ ਸਟੋਕ ਸਟੋਕ ਸਾਰਾ ਸਾਡੇ ਕੋਲ ਭਰਿਆ ਪਿਆ ਅਵੇਲੇਬਲ ਆ ਜਿੰਨਾਂ ਤੁਸੀਂ ਕਹੋਗੇ ਨਿਊ ਤੇ ਨਿਊ ਅਰਾਈਵਲ ਹੋਇਆ ਸਾਡੇ ਕੋਲ ਪੇਟੀਆਂ ਪਿੱਛੇ ਪਈਆਂ ਨੇ ਖੋਲਣ ਆਲੀਆਂ ਹਜੇ ਪਹਿਲਾਂ ਦੁਕਾਨ ਸਾਡੀ ਭਰੀ ਪਈ ਆ ਮਤਲਬ ਕਾਫੀ ਸਾਡਾ ਸ਼ੋਰੂਮ ਵੱਡਾ ਛੋਟੀ ਮੋਟੀ ਦੁਕਾਨ ਨਹੀਂ ਹੈਗੀ ਤੇ ਸਾਡੇ ਕੋਲ ਸਾਰਾ ਸ਼ੋਰੂਮ ਭਰਿਆ ਤੇ ਪਿੱਛੇ ਗੁਦਾਮ ਚ ਵੀ ਬਹੁਤ ਪਏ ਨੇ ਜੋ ਤੁਸੀਂ ਕਹੋਗੇ ਜਿਵੇਂ ਜਿਵੇਂ ਬੰਦਿਆਂ ਨੂੰ ਸਲੈਕਟ ਆਈ ਜਾਣਗੇ ਆਪਾਂ ਉਸ ਹਿਸਾਬ ਨਾਲ ਗੱਲ ਕਰਾਂਗੇ ਤੇ ਬਾਕੀ ਬਿੱਲ ਵੀ ਤੁਸੀਂ ਜਾਇਜ਼ ਟੈਂਸ਼ਨ ਨਾ ਲਓ ਮੈਂ ਪੂਰਾ ਐਨ ਓਕੇ ਵਿਦਆਊਟ ਜੀਐਸਟੀ ਐਂਨ ਪ੍ਰੋਪਰ ਕੱਟ ਕੇ ਦਊਂਗਾ ਬਿਲ ਤੁਹਾਡਾ ਇਹ ਕਪੂਰਥਲੇ ਭਾਜੀ ਕਪੂਰਥਲੇ ਨਾ ਬੱਸ ਸਟੈਂਡ ਆ ਕਪੂਰਥਲਾ ਜਿਹੜਾ ਬੱਸ ਸਟੈਂਡ ਤੋਂ ਨਾ ਥੋੜਾ ਜਿਹਾ ਅੱਗੇ ਦੋ ਗਲੀਆਂ ਟੱਪ ਕੇ ਇੱਕ ਉਹ ਆਜੀ ਫੈਸ਼ਨ ਡਿਜ਼ਾਇਨਿੰਗ ਦਾ ਲਿਖਿਆ ਹੋਊਗਾ ਤੁਹਾਨੂੰ ਬੋਰਡ ਦਿਖ ਜਾਏਗਾ ਗੜੀ ਚ ਨੂੰ ਵੜ ਕੇ ਆ ਜੀ ਹਾਂਜੀ ਭਾਅ ਜੀ ਤੇ ਜਰੂਰ ਵਿਜਿਟ ਕਰਿਓ ਭਾਅ ਜੀ ਸਾਡੇ ਭਾਅ ਜੀ ਓਪਨ ਚੋਵੀ ਘੰਟੇ ਓਪਨ ਰਹਿੰਦੀ ਆ ਦੁਕਾਨ ਸਾਡੀ ਸਿਰਫ ਰਾਤ ਨੂੰ ਅਸੀਂ ਨਹੀਂ ਨਹੀਂ ਰਾਤ ਨੂੰ ਭਾਅ ਜੀ ਅਸੀਂ ਨਾ ਸਿਰਫ ਬਾਰਾਂ ਵਜੇ ਤੋਂ ਲੈ ਕੇ ਸਵੇਰ ਦੇ ਸੱਤ ਵਜੇ ਤੱਕ ਬੰਦ ਕਰਦੇ ਆਂ ਨਹੀਂ ਸਾਡੀ ਖੁੱਲੀ ਰਹਿੰਦੀ ਬਾਰਾਂ ਵਜੇ ਤੱਕ ਦੁਕਾਨ ਹਾਂਜੀ ਕਸਟਮਰ ਨਾ ਦੂਰ ਦੂਰ ਤੋਂ ਬਹੁਤ ਆਉਂਦੇ ਨੇ ਕਈ ਵਾਰੀ ਫਿਰ ਉਹਨਾ ਸ਼ਾਮ ਨੂੰ ਤੁਰਦੇ ਨੇ ਬੰਦਾ ਸਲੈਕਟ ਕਰਨੇ ਡਿਜ਼ਾਇਨ ਲੈ ਕੇ ਜਾਣੇ ਪੈਕ ਕਰਨੇ ਤਾਂ ਫਿਰ ਨਾਈਟ ਹੋ ਜਾਂਦੀ ਕਈ ਵਾਰ ਉਹਨਾਂ ਨੂੰ ਫਿਰ ਉਹ ਫਿਰ ਅਸੀਂ ਵੀ ਫਿਰ ਬਾਰਾਂ ਵਜੇ ਰੱਖਿਆ ਸਵੇਰੇ ਸੱਤ ਵਜੇ ਖੋਲ ਦਿੰਦੇ ਆ ਰਾਤ ਬਾਰਾਂ ਵਜੇ ਕਲੋਜਿੰਗ ਆ ਤੇ ਸੰਡੇ ਬੰਦ ਹੁੰਦੀ ਹੈ ਜੀ ਹਾਂਜੀ ਸੰਡੇ ਕਲੋਜ ਆ ਜੀ ਉਹ ਫੈਮਲੀ ਨਾਲ ਵੀ ਟਾਈਮ ਸਪੈਂਡ ਕਰਨਾ ਜਰੂਰੀ ਹੈ ਜੀ ਥੈਂਕਯੂ ਭਾਅ ਜੀ ਥੈਂਕਯੂ ਜੀ ਜਰੂਰ ਭਾਜੀ ਜਰੂਰ ਜਰੂਰ ਭਾਅ ਜੀ ਕੱਪੜੇ ਦੀ ਗਰੰਟੀ ਹੋਊਗੀ ਕੋਈ ਚੱਕਰ ਨਹੀਂ ਉਹ ਟੈਂਸ਼ਨ ਨਾ ਲ ਤੁਸੀਂ ਓਕੇ ਓਕੇ ਭਾਅ ਜੀ ਥੈਂਕਯੂ ਭਾਅ ਜੀ ਥੈਂਕਯੂ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭਾਅ ਜੀ